ਮੈਂ ਨਾ ਨਵਾਂ ਘਰ ਲਿਆ ਏ ਤੇ ਮੈਨੂੰ ਆਪਣੇ ਨਵੇਂ ਘਰ ਦੇ ਵਿੱਚ ਫੋਨ ਆਇਆ ਵੀ ਤੁਹਾਡੇ ਫੋਨ ਦੇ ਬਿਲ ਵਗੈਰਾ ਨਾ ਪਹਿਲੇ ਪਤੇ ਤੇ ਜਾਈ ਜਾਂਦੇ ਨੇ ਤੇ ਮੈਂ ਘਰ ਆਪਣਾ ਲੈਣ ਤੇ ਇਧਰ ਉਧਰ ਸ਼ਿਫਟ ਕਰਨ ਦੇ ਚੱਕਰ ਦੇ ਵਿੱਚ ਮੇਰੇ ਕੋਲ ਟਾਈਮ ਨਹੀਂ ਸੀਗਾ ਵੀ ਮੈਂ ਜਾ ਕੇ ਉਥੇ ਆਪਣਾ ਨਵਾਂ ਐਡਰੈਸ ਲਿਖਾ ਸਕਦੇ ਹੋ ਉਹਨਾਂ ਨੂੰ ਤੇ ਇਹਦੇ ਚੱਕਰ ਦੇ ਵਿੱਚ ਮੈਨੂੰ ਦੋ ਮਹੀਨੇ ਦਾ ਜੋ ਮੇਰਾ ਬਿਲ ਇਕੱਠਾ ਹੋ ਗਿਆ ਸੀ ਨਾਲ ਕਾਫੀ ਜੁਰਮਾਨਾ ਵੀ ਲੱਗ ਗਿਆ ਫਿਰ ਮੈਂ ਉਥੇ ਜਾ ਕੇ ਉਹਨਾਂ ਨੂੰ ਰਿਕੈਸਟ ਕਰੀ ਵੀ ਬੇਨਤੀ ਕਰੀ ਵੀ ਚਲੋ ਮੇਰਾ ਜੁਰਮਾਨਾ ਵਗੈਰਾ ਮਾਫ ਕਰਕੇ ਵੀ ਮੈਨੂੰ ਬਿੱਲ ਅਦਾ ਕਰ ਦਵਾਂ ਮੈਂ ਤੇ ਉਹਨਾਂ ਨੇ ਫਿਰ ਮੇਰੀ ਬੇਨਤੀ ਨੂੰ ਸਵੀਕਾਰ ਕਰਦੇ ਹੋਏ ਮੇਰੇ ਕੋਲੋਂ ਦੋ ਮਹੀਨੇ ਦਾ ਬਿੱਲ ਲੈ ਲਿਆ ਤੇ ਇਸ ਲਈ ਮੈਂ ਉਹਨਾਂ ਦਾ ਬਹੁਤ ਬਹੁਤ ਸ਼ੁਕਰੀਆ ਕਰਦੀਆਂ ਤੇ ਨਾਲੇ ਆਪਣਾ ਮੈਂ ਜਿਹੜਾ ਨਵਾਂ ਐਡਰੈਸ ਆ ਉਹ ਵੀ ਉਹਨਾਂ ਨੂੰ ਲਿਖਵਾ ਦਿੱਤਾ ਹੈ ਤੇ ਹੁਣ ਤੋਂ ਮੈਨੂੰ ਨਵੇਂ ਐਡਰੈੱਸ ਤੇ ਹੀ ਬਿੱਲ ਭੇਜਿਆ ਕਰਨਗੇ ਮੈਂ ਉਹਨਾਂ ਦੀ ਬਹੁਤ ਧੰਨਵਾਦੀ ਆਂ